ਵਰਤਮਾਨ ਸਮੇਂ ਵਿੱਚ ਸਾਡਾ ਅਧਿਆਤਮਕ ਮਨਪਸੰਦ ਗੁਰੂ ਸਾਡੇ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਜਿਨ੍ਹਾਂ ਬਾਰੇ ਸਾਨੂੰ ਆਪਣੀ ਪਰਿਵਾਰ ਤੋਂ ਪਤਾ ਲੱਗਾ